ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਕੁਦਰਤੀ ਸਰੋਤ ਅਤੇ ਵਾਤਾਵਰਣ ਸੰਬੰਧੀ ਸੰ ਚੁਣੌਤੀਆਂ ਕਾਫੀ ਹਨ ਜਿਵੇਂ ਪਾਣੀ ਨੂੰ ਲੈ ਕੇ ਆਹ ਅੱਜ ਕੱਲ੍ਹ ਲੋਕ ਪਾਣੀ ਬਹੁਤ ਜ਼ਿਆਦਾ ਖਰਾਬ ਕਰ ਰਹੇ ਹਨ ਬੇਵਜ੍ਹਾ ਪਾਣੀ ਨੂੰ ਚਲਦਾ ਛੱਡ ਦਿੰਦੇ ਹਨ ਜਿੱਥੇ ਜ਼ਰੂਰਤ ਨਹੀਂ ਹੁੰਦੀ ਉੱਥੇ ਵੀ ਪਾਣੀ ਇਸਤੇਮਾਲ ਕਰਦੇ ਹਨ ਅਗਰ ਅਸੀਂ ਜੰਗਲਾਂ ਦੀ ਗੱਲ ਕਰੀਏ ਤਾਂ ਜੰਗਲਾਂ ਨੂੰ ਕੱਟ ਕੇ ਉੱਥੇ ਫੈਕਟਰੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਦਾ ਸਭ ਤੋਂ ਬੜਾ ਨੁਕਸਾਨ ਜਾਨਵਰਾਂ ਨੂੰ ਹੋ ਰਿਹਾ ਹੈ ਉਹਨਾਂ ਦਾ ਰਹਿ ਰਹਿਣ ਲਈ ਕੋਈ ਥਾਂ ਨਹੀਂ ਬਚ ਰਹੀ ਪ੍ਰਦੂਸ਼ਣ ਰੂਪਨਗਰ ਵਿੱਚ ਸਭ ਤੋਂ ਜ਼ਿਆਦਾ ਵੱਧ ਰਿਹਾ ਹੈ ਜ ਜਿੱਦਾਂ ਜਿੱਦਾਂ ਆਵਾਜਾਈ ਵਧੀ ਜਾ ਰਹੀ ਹੈ ਪ੍ਰਦੂਸ਼ਣ ਦੇ ਸਰੋਤ ਵੀ ਉੱਦਾਂ ਹੀ ਵੱਧ ਰਹੇ ਹਨ ਹਰ ਮਨੁੱਖ ਕੋਲ ਆਪਣਾ ਆਪਣਾ ਸਾਧਨ ਹੋਣ ਦੇ ਕਾਰਨ ਪ੍ਰਦੂਸ਼ਣ ਦਾ ਵਧਣਾ ਆਮ ਤੌਰ 'ਤੇ ਹੋਰ ਜ਼ਿਆਦਾ ਵੱਧ ਚੁੱਕਿਆ ਹੈ ਰੂਪਨਗਰ ਜ਼ਿਲ੍ਹੇ ਵਿੱਚ ਪਾਣੀ ਦਾ ਮੇਨ ਸਰੋਤ ਸਤਲੁਜ ਨਦੀ ਹੈ ਸਤਲੁਜ ਨਦੀ ਦੁਆਰਾ ਹੀ ਪੂਰੇ ਜ਼ਿਲ੍ਹੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਿੱਤਾ ਜਾਂਦਾ ਹੈ ਜ਼ਿਲ੍ਹੇ ਵਿੱਚ ਸਾਫ਼ ਸਫ਼ਾਈ ਕਰਵਾਉਣ ਦਾ ਵੀ ਕਾਫੀ ਸਾਫ਼ ਸਫ਼ਾਈ ਕਾਫੀ ਸਾਫ਼ ਸਫ਼ਾਈ ਵਿੱਚ ਵੀ ਕਾਫੀ ਬਦਲਾਵ ਹੈ ਸਰਕਾਰ ਦੁਆਰਾ ਕਾਫੀ ਜ਼ਿਆਦਾ ਰੈਲੀਆਂ ਚਲਾਈਆਂ ਜਾਂਦੀਆਂ ਹਨ ਕਾਫੀ ਅਭਿਆਨ ਚਲਾਏ ਜਾਂਦੇ ਹਨ ਜਿਸ ਵਿੱਚ ਨੌਜਵਾਨ ਸਕੂਲ ਦੇ ਵਿਦਿਆਰਥੀ ਅਤੇ ਆਮ ਜਨਤਾ ਵੀ ਕਾਫੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ